ਮੇਰਾ ਮਨ ਪਸੰਦ ਅਖ਼ਬਾਰ ਸਪੋਕਸਮੈਨ ਹੈ ਅਤੇ ਉਸ ਵਿੱਚ ਖ਼ਬਰਾਂ ਸਹੀ ਆਉਂਦੀਆਂ ਸਨ ਅਤੇ ਹੁਣ ਜੋ ਮੈਂ ਥੋੜ੍ਹੇ ਚਿਰ ਤੋਂ ਅਜੀਤ ਅਖ਼ਬਾਰ ਪੜ੍ਹਨ ਲੱਗਿਆ ਸੀ ਉਸ ਵਿੱਚ ਉਸ ਤਰੀਕੇ ਦੀਆਂ ਖ਼ਬਰਾਂ ਨਹੀਂ ਹੁੰਦੀਆਂ ਇਸ ਕਰਕੇ ਕਈ ਝੂਠੀਆਂ ਵੀ ਖ਼ਬਰਾਂ ਹੋ ਜਾਂਦੀਆਂ ਹਨ ਸੋ ਉਹਨਾਂ ਦੇ ਵਿੱਚ ਇਹ ਅਖ਼ਬਾਰਾਂ ਦੇ ਵਿੱਚ ਵੈਸੇ ਰਲਵਾਂ ਮਿਲਵਾਂ ਜਾਂ ਕੋਈ ਮਾੜਾ ਮੋਟਾ ਫ਼ਰਕ ਹੋ ਸਕਦਾ ਹੈ